ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਅੱਜ ਤੁਹਾਨੂੰ ਦੋ ਗੱਲਾਂ ਦੱਸਣ ਜਾ ਰਹੀ ਹਾਂ ਜੋ ਕਿ ਮੈਂ ਅੱਜ ਤੱਕ ਜਦੋਂ ਦੀ ਚਿੱਤਰਕਾਰੀ ਕਰ ਰਹੀ ਹਾਂ ਅਤੇ ਜੋ ਇਮੋਸ਼ਨਸ ਮੈਂ ਫੇਸ ਕੀਤੀਆਂ ਹਾਂ ਵੈਸੇ ਤਾਂ ਮੈਨੂੰ ਚਿੱਤਰਕਾਰੀ ਕਰਦੇ ਕਾਫੀ ਸਮਾਂ ਹੋ ਗਿਆ ਹੈ ਅਤੇ ਹੁਣ ਮੈਂ ਕਾਫੀ ਤਰ੍ਹਾਂ ਦੀ ਚਿੱਤਰਕਾਰੀ ਕਰ ਲੈਂਦੀ ਹਾਂ ਪਰ ਚਾਹੇ ਕੋਈ ਕਿੰਨੇ ਵੀ ਪਰਫੈਕਟ ਹੋਏ ਪਰ ਕਦੇ ਨਾ ਕਦੇ ਤਾਂ ਜਦੋਂ ਅਸੀਂ ਚਿੱਤਰਕਾਰੀ ਕਰਦੇ ਹਾਂ ਅਤੇ ਕੁਛ ਨਾ ਕੁਛ ਵੀ ਬੜੀ ਵੱਡੀ ਸਮੱਸਿਆ ਆ ਆ ਹੀ ਜਾਂਦੀ ਹੈ ਜਿਵੇਂ ਕਿ ਮੈਂ ਕਈ ਵਾਰ ਜਦੋਂ ਕਿਸੇ ਦਾ ਕਿਸੇ ਵਿਅਕਤੀ ਦਾ ਚਿਹਰਾ ਬਣਾਉਂਦੀ ਹਾਂ ਤਾਂ ਮੈਨੂੰ ਕਈ ਵਾਰ ਦਿੱਕਤ ਆ ਜਾਂਦੀ ਹੈ ਕਈ ਵਾਰ ਤਾਂ ਕਿਸੇ ਦਾ ਨੱਕ ਸਹੀ ਨਹੀਂ ਬਣਦਾ ਕਈ ਵਾਰੀ ਅੱਖਾਂ ਸਹੀ ਨਹੀਂ ਬਣਦੀਆਂ ਗੱਲਾਂ ਕੰਨ ਮਤਲਬ ਸਹੀ ਨਹੀਂ ਮਿਲਦੇ ਅਤੇ ਬਹੁਤ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਪਰ ਮੈਂ ਹੁਣ ਆਪਣੀ ਇਹੋ ਗਲਤੀਆਂ ਨੂੰ ਬਹੁਤ ਸੁਜਾ ਸੁਧਾਰ ਰਹੀ ਹਾਂ ਧੰਨਵਾਦ